ਹੈਲੋ ਜੀ ਨਮਸਕਾਰ ਜੀ ਨਮਸਕਾਰ ਜੀ ਹੋਰ ਕੀ ਹਾਲ ਹੈ ਕੌਣ ਹਾਂਜੀ ਕੌਣ ਬੋਲਦੇ ਜੀ ਅੱਛਾ ਜੀ ਅੱਛਾ ਜੀ

ਹਾਂਜੀ ਗੁਰਦੁਆਰੇ ਤਾਂ ਸਾਡੇ ਸੁਜਾਨਪੁਰ ਵੀ ਦੋ ਗੁਰਦੁਆਰੇ ਨੇ ਅਤੇ ਉਂਝ ਤਾਂ ਹਰ ਪਿੰਡ ਵਿੱਚ ਗੁਰਦੁਆਰਾ ਅਤੇ ਜੇ ਤੁਸੀਂ ਕੋਈ ਇਤਿਹਾਸਿਕ ਗੁਰਦੁਆਰਾ ਦੇ ਜਾਣਾ ਚਾਹੁੰਦੇ ਹੋ ਉਹ ਬਾਠ ਸਾਹਿਬ ਹੈ ਗੁਰਦੁਆਰਾ ਨਾ ਉਹ ਗੁਰਦੁਆਰੇ ਦੀ ਬੜੀ ਮਾਨਤਾ ਉਹ ਸ੍ਰੀ ਪਹਿਲੇ ਜਿਹੜੇ ਗੁਰੂ ਸੀ ਨਾ ਸਾਡੇ ਗੁਰੂ ਨਾਨਕ ਦੇਵ ਜੀ ਉਹਨਾਂ ਦੇ ਸਪੁੱਤਰ ਦੇ ਯਾਦ ਵਿੱਚ ਹੈ ਉਹਨਾਂ ਦੇ ਸਪੁੱਤਰ ਸੀ ਨਾ ਬਾਬਾ ਸ੍ਰੀ ਚੰਦ ਜੀ ਅਤੇ ਉਹ ਉਹਨਾਂ ਦੀ ਨਾਲ ਇਤਿਹਾਸਿਕ ਸੰਬੰਧ ਰੱਖਦਾ ਅਤੇ ਉਂਝ ਕਹਿੰਦੇ ਵੀ ਵ ਉੱਥੇ ਮਤਲਬ ਕਿ ਹਰ ਸੰਗਰਾਂਦ ਨੂੰ ਲੋਕ ਦੂਰੋਂ ਦੂਰੋੋਂ ਇਸ਼ਨਾਨ ਕਰਨ ਵਾਸਤੇ ਆਉਂਦੇ ਨੇ ਅਤੇ ਬੜੀ ਹੀ ਇਤਿਹਾਸਿਕ ਮਹਾਨਤਾ ਹੈ ਨਾ ਅਤੇ ਤੁਸੀਂ ਉਹ ਗੁਰਦੁਆਰੇ ਯਾਤਰਾ ਕਰੋ ਦਰਸ਼ਨ ਕਰੋ ਉੱਥੇ ਇਸ਼ਨਾਨ ਕਰੋ ਬੜਾ ਵਧੀਆ ਗੁਰਦੁਆਰਾ ਹਾਂਜੀ ਅਤੇ ਦੇਖੋ ਜੀ ਹੁਣ ਤੁਸੀਂ ਕਿਹੜੇ ਕੀ ਕਿਸ ਜਗ੍ਹਾ 'ਤੇ ਹੋ ਅੱਛਾ ਹੁਣ ਤਾਂ ਰਾਤ ਹੋੋਈ ਵੀ ਆ ਤੁਸੀਂ ਮੈਂ ਕਹਿੰਦਾ ਰਾਤ ਤੁਸੀਂ ਉੱਥੇ ਸਟੇਅ ਕਰੋਗੇ ਫਿਰ ਤੁਸੀਂ ਸਵੇਰੇ ਜਦੋਂ ਉੱਥੇ ਰਾਤ ਤਾਂ ਮਤਲਬ ਕਿ ਕਿਸੇ ਹੋਟਲ ਵਿੱਚ ਤੁਸੀਂ ਠਹਿਰ ਸਕਦੇ ਹੋ ਜੇ ਕੋਈ ਹੋਰ ਪੀ ਜੀ ਕੋਈ ਹੋਏਗਾ ਅਤੇ ਉੱਥੋਂ ਤੁਸੀਂ ਪੁੱਛ ਸਕਦੇ ਹੋ ਨਹੀਂ ਤਾਂ ਹਾਂ ਤੁਸੀਂ ਜੇ ਤੁਸੀਂ ਹੁਣ ਜਾਣਾ ਚਾਹੁੰਦੇ ਆਟੋ ਕਰਕੇ ਹੁਣ ਵੈਸੇ ਹਨੇਰਾ ਹੋ ਜਾਣਾ ਪਰ ਤੁਸੀਂ ਪਠਾਨਕੋਟ ਹੀ ਸਟੇਅ ਕਰ ਲਿਓ ਅਤੇ ਸਵੇਰੇ ਤੁਸੀਂ ਉੱਠ ਕੇ ਨਾ ਅਤੇ ਫਿਰ ਇਹ ਆ ਵੀ ਇੱਥੋਂ ਪਠਾਨਕੋਟ ਬੱਸ ਸਟੈਂਡ ਤੋਂ ਦੇਖੋ ਬੱਸਾਂ ਮਿੰਨੀ ਬੱਸਾਂ ਜਾਂਦੀਆਂ ਉੱਧਰ ਨੂੰ ਉਹਦੇ 'ਚ ਵੀ ਤੁਸੀਂ ਬੈਠ ਸਕਦੇ ਹੋ ਅਤੇ ਫਿਰ ਆਟੋ ਜਿਹੜਾ ਆ ਆਟੋ 'ਤੇ ਵੀ ਕਰਕੇ ਤੁਸੀਂ ਜਾ ਸਕਦੇ ਹੋ ਇੱਥੇ ਆਟੋ 'ਚ ਤੁਸੀਂ ਬੜੀ ਵਧੀਆ ਜਗ੍ਹਾ ਦੁਨੀਆ ਰੋਜ਼ ਉੱਥੇ ਆਈ ਵੀ ਹੁੰਦੀ ਹੈ ਯਾਤਰਾ ਕਰਨ ਉੱਥੇ ਅਤੇ ਤੁਸੀਂ ਉੱਥੇ ਆ ਜਾ ਜਾ ਸਕਦੇ ਹੋ ਓਕੇ ਜੀ ਓਕੇ